ਹੈਲੋ

ਸਤਿ ਸ਼੍ਰੀ ਅਕਾਲ ਜੀ ਸਰ ਸਰ ਹਰਮਨਪ੍ਰੀਤ ਸਿੰਘ ਗੱਲ ਕਰ ਰਿਹਾ ਸੀਗਾ ਜੀ ਹਰਦੀਪ ਸਿੰਘ ਬੋਲ ਰਹੇ ਸਰ ਮੈਂ ਮਾਨਸਾ ਜ਼ਿਲ੍ਹੇ ਦੇ ਵਿੱਚ ਐਜ ਏ ਟੂਰਿਸਟ ਆਇਆ ਗਾ ਜੀ ਤੁਹਾਡੇ ਤੋਂ ਥੋੜ੍ਹੀ ਜਾਣਕਾਰੀ ਲੈਣੀ ਸੀ ਮਾਨਸਾ ਦੇ ਵਿੱਚ ਵਿੱਦਿਅਕ ਅਦਾਰੇ ਕਿਹੜੇ ਕਿਹੜੇ ਨੇ ਜੀ ਜਿਹੜੇ ਮਤਲਬ ਕਿ ਪੂਰੇ ਪੰਜਾਬ 'ਚ ਜਿਹਨਾਂ ਦਾ ਨਾਮ ਹੋਵੇ

ਇਹ ਸਰਕਾਰੀ ਕਾਲਜ ਜਾਂ ਪ੍ਰਾਈਵੇਟ ਆ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਹੋਰ ਮਾਨਸਾ ਦੇ ਵਿੱਚ ਘੁੰਮਣ ਦੇ ਲਈ ਮਾਨਸਾ ਦੇ ਵਿੱਚ ਕੀ ਜਗ੍ਹਾ ਹੈ ਕੋਈ

ਐਕਸਰਸਾਈਜ਼ ਕਰਨ ਦੇ ਲਈ ਕੋਈ ਗਰਾਊਂਡ ਵਗੈਰਾ ਉੱਥੇ ਹਾਂਜੀ ਅੱਛਾ ਜੀ ਜਿਹੜੇ ਉੱਥੇ ਗਰਾਊਂਡ ਬਣੇ ਹੋਏ ਨੇਗੇ ਜੀ ਓਹੋ ਕੋਟ ਉਹਦੇ ਵੁਡਨ ਨੇ ਜਾਂ ਕੰਕਰੀਟ ਦੇ ਨੇ ਠੀਕ ਹੈ ਜੀ ਠੀਕ ਹੈ ਜੀ ਹੋਰ ਇੱਥੇ ਸਰਕਾਰ ਵੱਲੋਂ ਸਹੂਲਤ ਕੀ ਹੈ ਕੋਈ ਸਰਕਾਰੀ ਗੌਰਮੈਂਟ ਹੋਸਪਿਟਲ ਹੈ ਇੱਥੇ

ਠੀਕ ਹੈ ਜੀ ਠੀਕ ਹੈ

ਠੀਕ ਹੈ ਜੀ ਠੀਕ ਹੈ ਸਰ ਥੈਂਕ ਯੂ ਜੀ ਓਕੇ